ਮੈਨੂੰ ਪੇਂਟਿੰਗ ਕਰਨ ਦਾ ਬਚਪਨ ਤੋਂ ਹੀ ਸ਼ੌਂਕ ਸੀ ਪਰ ਹਲੇ ਤੱਕ ਦਾ ਮੇਰਾ ਸਭ ਤੋਂ ਜ਼ਿਆਦਾ ਵਧੀਆ ਮਾਸਟਰਪੀਸ ਕ੍ਰਿਸ਼ਨ ਅਤੇ ਰਾਧਾ ਜੀ ਦੀ ਡਰਾਇੰਗ ਰਹੀ ਹੈ ਉਸ ਪੇਂਟਿੰਗ ਨੂੰ ਬਣਾਉਣ ਲਈ ਮੈਨੂੰ ਲਗਭਗ ਤੀਹ ਘੰਟੇ ਲੱਗ ਗਏ ਸੀ ਮੈਂ ਪਹਿਲਾਂ ਤਾਂ ਸਾਰੀ ਡਿਜ਼ਾਇਨਿੰਗ ਕੀਤੀ ਕਿ ਮੈਂ ਕਿਵੇਂ ਰਾਧਾ ਅਤੇ ਕ੍ਰਿਸ਼ਨ ਜੀ ਨੂੰ ਦਿਖਾਉਣਾ ਚਾਹੁੰਦੀ ਹਾਂ ਉਸ ਤੋਂ ਬਾਅਦ ਮੈਂ ਉਹਦੀ ਆਊਟਲਾਈਨ ਵਗੈਰਾ ਕਰਕੇ ਅੰਦਰ ਪੇਂਟ ਕੀਤਾ ਅਤੇ ਉਹਨੂੰ ਰੰਗੀਨ ਬਣਾਇਆ ਜਿਵੇਂ ਕਿ ਉਹ ਰੀਅਲਿਸਟਿਕ ਪੇਂਟਿੰਗ ਦਾ ਰੂਪ ਲੈ ਸਕੇ